ਛੱਬੀ ਮਾਰਚ ਦੋ ਹਜ਼ਾਰ ਇੱਕ ਪੰਦਰਾਂ ਅਗਸਤ ਦੋ ਹਜ਼ਾਰ ਇੱਕੀ ਤੇਈ ਫਰਵਰੀ ਉੱਨੀ ਸੌ ਅਠਾਨਵੇਂ ਚੌਦ੍ਹਾਂ ਅਗਸਤ ਉੱਨੀ ਸੌ ਸੈਂਤੀ ਪੱਚੀ ਮਈ ਦੋ ਹਜ਼ਾਰ ਵੀਹ